ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਕੋਲ ਏਜੰਸੀ ਤੋਂ ਗੱਲ ਕਰ ਰਹੇ ਹੋ ਜੀ ਅਤੇ ਅਸੀਂ ਕੈਬ ਬੁੱਕ ਕਰਵਾਈ ਸੀ ਅਤੇ ਡਰਾਈਵਰ ਨਾ ਅਸੀਂ ਫੋਨ ਕਰ ਰਹੇ ਹਾਂ ਡਰਾਈਵਰ ਨੂੰ ਅਤੇ ਡਰਾਈਵਰ ਪਹਿਲਾਂ ਤਾਂ ਕੋਲ ਨਹੀਂ ਚੱਕ ਰਿਹਾ ਜੀ ਉਹਨੇ ਫੋਨ ਕੋਲ ਚੱਕੀ ਸੀ ਅਤੇ ਸਾਡੇ ਗਲ਼ ਪੈ ਗਿਆ ਇਸ 'ਚ ਸਾਡਾ ਕੀ ਕਸੂਰ ਹੈ ਅਸੀਂ ਪੈਸੇ ਦਿੱਤੇ ਨੇ ਅਸੀਂ ਕੈਬ ਬੁੱਕ ਕਰਵਾਈ ਹੈ ਅਤੇ ਹੁਣ ਅਸੀਂ ਦੁਬਾਰਾ ਫੋਨ ਕਰ ਰਹੇ ਹਾਂ ਇਹਦਾ ਨੰਬਰ ਹੀ ਸੰਪਰਕ ਪਹੁੰਚ ਤੋਂ ਬਾਹਰ ਆ ਰਿਹਾ ਹੈ ਜੀ ਹੁਣ ਅਸੀਂ ਇਸ 'ਚ ਦੱਸੋ ਕੀ ਕਰੀਏ ਅਸੀਂ ਕੰਪਲੇਂਟ ਕਰਨੀ ਹੈ ਉਸ ਕੈਬ ਡਰਾਈਵਰ ਖਿਲਾਫ ਅਤੇ ਇੰਨੀ ਗੱਲ ਦੇਖੋ ਜੀ ਏਜੰਸੀ ਤੁਹਾਡੀ ਆ ਅਤੇ ਗੱਲ ਵੀ ਥ ਜਿੰਨੀ ਹੋਏਗੀ ਤੁਹਾਡੇ 'ਤੇ ਹੀ ਆਉਣੀ ਹੈ ਜੀ ਮੁੜ ਫੁੜ ਕੇ ਤੁਹਾਡੇ 'ਤੇ ਗੱਲ ਆਏਗੀ ਕਸੂਰ ਬੇਸ਼ੱਕ ਡਰਾਈਵਰ ਦਾ ਮੇਨ ਬੰਦਾ ਤੁਸੀਂ ਹੋ ਜੀ ਸਾਰੀਆਂ ਗੱਡੀਆਂ ਤੁਹਾਡੇ ਨਾਂ 'ਤੇ ਚੱਲ ਰਹੀਆਂ ਠੀਕ ਹੈ ਨਾ ਤੁਹਾਡੇ ਗਲ ਪੈਣਾ ਪਬਲਿਕ ਨੇ ਆ ਕੇ ਅਸੀਂ ਪੈਸੇ ਦਿੱਤੇ ਨੇ ਸਾਡੇ ਗਲ਼ ਵੀ ਪੈ ਰਿਹਾ ਜੀ ਅਸੀਂ ਪੰਜ ਘੰਟੇ ਹੋ ਗਏ ਖੜ੍ਹੇ ਹਾਂ ਏਅਰਪੋਟ 'ਤੇ ਸਾਡੀ ਫਲਾਈਟ ਲੇਟ ਹੋ ਰਹੀ ਹੈ ਜੀ ਅਸੀਂ ਬਾਹਰ ਜ਼ਰੂਰੀ ਕੰਮ ਤੋਂ ਜਾਣਾ ਸੀ ਅਸੀਂ ਫੋਰਨ ਜਾਣਾ ਸੀ ਸਾਡਾ ਉੱਥੇ ਬਿਜ਼ਨਸ ਦਾ ਕੰਮ ਸੀ ਅਤੇ ਅਸੀਂ ਜੇ ਨਾ ਗਏ ਸਾਡਾ ਉੱਥੇ ਬਹੁਤ ਲੋਸ ਹੋ ਜਾਣਾ ਯਾਰ ਤੁਸੀਂ ਕੈਬ ਭੇਜ ਦਿਉ ਜੀ ਦੂਸਰੀ ਅੱਬਲ ਤਾਂ ਜੇ ਕੈਬ ਵੀ ਆਈ ਜੀ ਤਾਂ ਬਹੁਤ ਟਾਇਮ ਲੱਗ ਜਾਣਾ ਅਸੀਂ ਫਿਰ ਵੀ ਲੇਟ ਹੋ ਜਾਣਾ ਜੀ ਹੁਣ ਇਹ 'ਚ ਦੱਸੋ ਅਸੀਂ ਕੀ ਕਰੀਏ ਜਵਾਬ ਜਵਾਬਦਾਰ ਤੁਸੀਂ ਹੋ ਦੱਸੋ ਹੁਣ ਕੀ ਕਰੀਏ ਨਾ ਤਾਂ ਡਰਾਈਵਰ ਫੋਨ ਚੱਕਦਾ ਜੇ ਕੋਈ ਮਜ਼ਬੂਰੀ ਹੈ ਸਾਨੂੰ ਦੱਸ ਸਕਦਾ ਸੀ ਫੋਨ ਕਰਕੇ ਗਲ਼ ਪੈਣ ਦਾ ਤਾਂ ਕੋਈ ਮਤਲਬ ਨਹੀਂ ਗਲ਼ ਤਾਂ ਐਵੇਂ ਪੈ ਰਿਹਾ ਜਿਵੇਂ ਦਾਰੂ ਪੀ ਕੇ ਗੱਡੀ ਚਲਾ ਰਿਹਾ ਹੋਵੇ ਜੀ ਦੱਸੋ ਤੁਸੀਂ ਇਹੋ ਜਿਹੇ ਡਰਾਈਵਰ ਰੱਖੇ ਹੋਏ ਨੇ ਹੁਣ ਬੰਦਾ ਕੀ ਕਰੇ ਜੀ ਪੈਸੇ ਦਿੱਤੇ ਹੋਏ ਨੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਰੁਕੋ ਮੈਂ ਚਲੋਂ ਮੈਂ ਸਮਝਦਾ ਅਗਲਾ ਕੀ ਕਰੇਗਾ ਜੇ ਬਾਏ ਚਾਂਸ ਕੋਈ ਜਾ ਰਿਹਾ ਕਿ ਉਹਦਾ ਐਕਸੀਡੈਂਟ ਹੋ ਜਾਵੇ ਫਿਰ ਕੀ ਕਰਾਂਗੇ ਜੀ ਸਾਡੇ ਚਲੋ ਬਿਜ਼ਨਸ ਲੋਸ ਹੋ ਰਿਹਾ ਅਸੀਂ ਉੱਥੇ ਫੋਨ ਕਰਕੇ ਮੀਟਿੰਗ ਅੱਗੇ ਕਰਵਾ ਲੈਂਦੇ ਹਾਂ ਚਲੋ ਕੋਈ ਚੱਕਰ ਨਹੀਂ ਐਡਾ ਚਲੋ ਠੀਕ ਹੈ ਜੀ ਤੁਸੀਂ ਮੈਂ ਕਹਿੰਦਾ ਤੁਸੀਂ ਕੰਪਲੇਂਟ ਸਾਡੀ ਦਰਜ ਕਰੋ ਬਾਅਦ 'ਚ ਤੁਹਾਨੂੰ ਮੈਂ ਮਿਲ ਕੇ ਜਾਵਾਂਗੇ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ ਜੀ